ਵਿੱਚ ਖੂਹ ਦੀ ਵਰਤੋਂ ਕਰਦੇ ਹਨ ਅਤੇ ਉਹ ਲੈ ਟੈਕਨੋਲਜੀ ਦੇ ਨਾਲ ਬਹੁਤ ਹੀ ਸ ਸੌ ਸੌਖੇ ਤਰੀਕੇ ਨਾਲ ਪਾਣੀ ਕੱਢ ਲੈਂਦੇ ਹਨ ਲਾਈਕ ਸ ਜਿਵੇਂ ਕਿ ਫਰਮਾਸੀਤਲ ਮੋਟਰਾਂ ਇੰਜਣ ਹੋਏ ਅਤੇ ਟੁੱਲੂ ਪੰਪਾਂ ਦੇ ਸਹਾਰੇ ਨਾਲ ਪਾਣੀ ਕੱਢ ਲਿਆ ਜਾਂਦਾ ਹੈ ਕਿ ਉਹ ਜੇ ਉਹੀ ਬਹੁਤ ਸੌਖਾ ਤਰੀਕਾ ਹੈ